ਮੈਂ ਸ਼ਹਿਰ ਵਿੱਚ ਰਹਿੰਦਾ ਹਾਂ ਅਤੇ ਮੈਨੂੰ ਨਾਲ ਦੇ ਪਿੰਡਾਂ ਵਿੱਚ ਜਾਣ ਦਾ ਕਈ ਵਾਰ ਮੌਕਾ ਮਿਲਦਾ ਹੈ ਕੁਝ ਸਥਾਨ ਤਾਂ ਅਜਿਹੇ ਹਨ ਜਿੱਥੇ ਮੈਂ ਹਰ ਰੋਜ਼ ਜਾਂਦਾ ਹਾਂ ਜਿਸ ਤਰ੍ਹਾਂ ਕਿ ਮੈਂ ਆਪਣੇ ਨਾਲ ਦੇ ਪਿੰਡ ਜੋ ਮੇਰੇ ਤੋਂ ਸਿਰਫ ਸਾਢੇ ਤਿੰਨ ਕਿਲੋਮੀਟਰ ਦੂਰ ਹੈ ਦੁੱਧ ਲੈਣ ਜਾਂਦਾ ਹਾਂ ਸ਼ਹਿਰ ਵਿੱਚ ਦੁੱਧ ਕੋਈ ਵਧੀਆ ਕੁਆਲਿਟੀ ਦਾ ਨਹੀਂ ਮਿਲਦਾ ਮਿਲਾਵਟ ਦਾ ਡਰ ਵੀ ਬਣਿਆ ਰਹਿੰਦਾ ਹੈ ਜਿਸ ਲਈ ਮੈਂ ਸ਼ੁੱਧ ਦੁੱਧ ਲਈ ਸ਼ਹਿਰ ਦੇ ਵਿੱਚੋਂ ਪਿੰਡ ਦੇ ਵਿੱਚ ਜਾਂਦਾ ਹਾਂ ਉਨਾਂ ਕੋਲ ਬਹੁਤ ਮੱਝਾਂ ਰੱਖੀਆਂ ਹੋਈਆਂ ਹਨ ਅਤੇ ਸਾਫ ਸੁਥਰੇ ਸਥਾਨ ਦੇ ਉੱਪਰ ਉਹ ਉਹਨਾਂ ਦੀ ਦੇਖਭਾਲ ਕਰਦੇ ਹਨ ਮੈਂ ਉਹਨਾਂ ਦੇ ਅੰਦਰ ਮੱਝਾਂ ਵਾਲੇ ਸਥਾਨ ਉੱਪਰ ਵੀ ਜਾਂਦਾ ਹਾਂ ਅਕਸਰ ਹੀ ਅਤੇ ਦੁੱਧ ਲੈ ਕੇ ਆਉਂਦਾ ਹਾਂ ਇਸ ਤੋਂ ਬਿਨਾਂ ਅਕਸਰ ਹੀ ਮੈਂ ਆਪਣੇ ਦੋਸਤ ਨੂੰ ਮਿਲਣ ਲਈ ਨਾਲ ਦੇ ਪਿੰਡਾਂ ਵਿੱਚ ਜਾਂਦਾ ਹਾਂ ਜਾਂ ਨੇੜੇ ਦੇ ਕਸਬੇ ਵਿੱਚ ਜਾਂਦਾ ਹਾਂ ਉਹ ਵੀ ਮੇਰੇ ਕੋਲ ਆਉਂਦੇ ਹਨ ਕਦੇ ਕਦਾਰ ਕਦੇ ਕਦਾਈ ਰਿਸ਼ਤੇਦਾਰੀ ਵਿੱਚ ਵੀ ਜਾਣਾ ਹੋ ਜਾਂਦਾ ਹੈ ਇਸ ਤਰ੍ਹਾਂ ਸਾਡਾ ਬਹੁਤ ਕੰਮਾਂ ਲਈ ਪਿੰਡਾਂ ਦੇ ਵਿੱਚ ਨਾਲ ਦੇ ਕਸਬਿਆਂ ਦੇ ਵਿੱਚ ਅਕਸਰ ਹੀ ਜਾਣਾ ਹੁੰਦਾ ਹੈ ਕਈ ਵਾਰ ਅਸੀਂ ਕਿਸੇ ਖਾਸ ਮਕਸਦ ਲਈ ਗੁਰਦੁਆਰਾ ਸਾਹਿਬ ਜਾਂ ਹੋਰ ਸਥਾਨ ਤੇ ਵਿਜਿਟ ਕਰਨ ਲਈ ਵੀ ਅਸੀਂ ਨਾਲ ਦੇ ਕਸਬਿਆਂ ਪਿੰਡਾਂ ਦੇ ਵਿੱਚ ਜਾਂਦੇ ਹਾਂ